ਹੈਲੋ ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਆਂ ਹੈਲੋ ਹਾਂ ਬਾਈ ਕਿਵੇਂ ਆ ਬਈ ਆਪਾਂ ਵਧੀਆ ਹੈਗੇ ਹਾਂ ਹੁਣੇ ਹੁਣੇ ਕਾਲਜ ਪਾਸ ਆਊਟ ਹੋਏ ਹਾਂ ਤੁਸੀਂ ਵੀ ਹੁਣੇ ਹਿਸਾਬ ਨਾਲ ਹੁਣੇ ਪਾਸ ਆਊਟ ਹੋਏ ਹਾਂ ਅੱਛਾ ਅਤੇ ਹੁਣ ਤੁਸੀਂ ਕਿਤੇ ਜੋਬ 'ਚ ਲੱਗੇ ਕਿ ਕਿਤੇ ਸੋਚ ਰਹੇ ਹੋ ਲੱਗਣਾ ਓਕੇ ਮੈਨੂੰ ਮੈਂ ਹੁਣੀ ਪਾਸ ਆਊਟ ਹੋਇਆ ਹਾਂ ਅਤੇ ਮੈਨੂੰ ਹਜੇ ਤੱਕ ਜੋਬ ਕੋਈ ਮਿਲ ਨਹੀਂ ਰਹੀ ਤਾਂ ਮੈਂ ਕਿਹਾ ਆਪਣੇ ਦੋਸਤਾਂ ਨੂੰ ਪੁੱਛ ਲਈਏ ਤੁਸੀਂ ਤੁਸੀਂ ਕੀ ਕੀਤਾ ਹੋਇਆ ਸੀਗਾ ਅੱਛਾ ਬੀਟੈਕ ਤੁਹਾਡੇ ਇੱਥੇ ਕਿਹੜੀ ਕਿਹੜੀ ਜੋਬਸ ਹੁੰਦੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਅਤੇ ਤੁਸੀਂ ਕਿਹੜੀ ਕੀਤੀ ਸੀਗੀ ਅਤੇ ਮਕੈਨੀਕਲ ਦੇ ਵਿੱਚ ਤੁਸੀਂ ਫਿਰ ਹੁਣ ਕਿਹੜੀ ਮਕੈਨੀਕਲ ਦੇ ਹਿਸਾਬ ਨਾਲ ਅੱਗੇ ਪਾਰਟ ਆ ਜਾਂਦੇ ਆ ਮੈਨੂੰ ਲੱਗਦਾ ਮੈਂ ਜਿਸ ਹਿਸਾਬ ਨਾਲ ਮੈਂ ਸੁਣਿਆ ਸੀਗਾ ਨਹੀਂ ਮੈਂ ਤੁਹਾਨੂੰ ਇਹ ਜਾਣਕਾਰੀ ਪੁੱਛਣੀ ਜੋਬ ਮਿਲ ਜੂ ਕਿਹੜੀ ਕਿਹੜੀ ਟਾਈਪ ਦੀ ਹੈਗੀ ਜਿਵੇਂ ਕਿ ਤੁਸੀਂ ਮਕੈਨੀਕਲ ਕਰ ਰਹੇ ਹੋ ਜਿਸ ਹਿਸਾਬ ਨਾਲ ਮੈਨੂੰ ਜਾਣਕਾਰੀ ਹੈਗੀ ਆ ਮੇਰੇ ਹਿਸਾਬ ਨਾਲ ਤੁਹਾਡੇ ਤਿੰਨ ਤੇ ਵਿਭਾਗ ਹਿੱਸਿਆਂ 'ਚ ਵੰਡਿਆ ਹੋਇਆ ਹੈ ਇੱਕ ਮੈਨੂੰਫੈਕਚਰਿੰਗ ਸੀਗਾ ਇੱਕ ਥਰਮਲ ਸੀਗਾ ਅਤੇ ਇੱਕ ਡਿਜ਼ਾਇਨ ਸੀਗਾ ਤੁਸੀਂ ਵੀ ਤੁਸੀਂ ਕਿਹਦੇ 'ਚ ਸੀਗੇ ਅਤੇ ਡਿਜ਼ਾਇਨਿੰਗ ਦੇ ਵਿੱਚ ਮਤਲਬ ਤੁਸੀਂ ਹੁਣ ਡਿਜ਼ਾਈਨਿੰਗ ਇੰਜੀਨੀਅਰ ਹੋ ਮਕੈਨੀਕਲ ਅਤੇ ਡਿਜ਼ਾਇਨਿੰਗ ਇੰਜੀਨੀਅਰ ਹੈਗੇ ਤੁਸੀਂ ਅਤੇ ਹੁਣ ਤੁਸੀਂ ਵੀ ਜੇ ਅਪਲਾਈ ਕਰਨ ਦਾ ਸੋਚ ਰਹੇ ਹੋ ਤੁਸੀਂ ਸਰਚ ਕਰਨ ਵਾਸਤੇ ਵੈਬਸਾਈਟ ਵਰਤ ਰਹੇ ਹੋ ਕੋਈ

ਅੱਛਾ ਅਤੇ ਅਗਰ ਵੀਰ ਜੀ ਕਰੰਟਲੀ ਮੈਂ ਹਜੇ ਆਪਣੇ ਮੈਥ ਦੇ ਵਿੱਚ ਐਮਐਸਈ ਕਰਕੇ ਹਟਿਆ ਹਾਂ ਅਤੇ ਮੈਂ ਅਗਰ ਆਪਣਾ ਇੱਦਾਂ ਪਾ ਦੇਵਾਂ ਲਿਕਡਇਨ ਤਾਂ ਮੈਨੂੰ ਸਕੂਲਾਂ ਜਾਂ ਕਾਲਜਜ ਦੇ ਵੱਲੋਂ ਓਪਰਚੁਨੀਟੀ ਆਉਣਗੀਆਂ ਮੈਂ ਮੈਂ ਮੈਂ ਮੈਂ ਐਮਐਸਈ ਕੀਤੀ ਹੋਈ ਹੈ ਮੈਥ ਦੇ ਵਿੱਚ ਅਤੇ ਮੈਂ ਮੈਂ ਕਰੰਟਲੀ ਵੈਸੇ ਐਮਐਸਈ ਕਰਨ ਤੋਂ ਬਾਅਦ ਜ਼ਿਆਦਾ ਟਾਈਮ ਲਾਗੇ ਜੀ ਮੈਂ ਹਜੇ ਰੀਸੈਂਟ ਪਾਸ ਆਊਟ ਹੋਇਆ ਹਾਂ ਤਾਂ ਮੇਰਾ ਥੋੜ੍ਹਾ ਔਖਾ ਹੋਵੇਗਾ ਮੈਨੂੰ ਕਰੰਟਲੀ ਕੋ ਹਾਂ ਉਹੀ ਉਹੀ ਤਾਂ ਇਸ ਕਰਕੇ ਮੈਂ ਪੁੱਛਣਾ ਸੀਗਾ ਕਿ ਜਿਹੜੇ ਕਰੰਟਲੀ ਜਿਹੜੇ ਆਪਣੇ ਦੂਜੇ ਦੇ ਟਾਈਪ ਦੇ ਇੰਸਟੀਟਿਊਟਸ ਹੈਗੇ ਆ ਜੀ ਇੰਸਟੀਟਿਊਟਸ ਨਹੀਂ ਮਤਲਬ ਕਿਹੜੇ ਉਹ ਹੁੰਦੇ ਐਲਨ ਟਾਈਪ ਵਗੈਰਾ ਫਿਜਿਕਸ ਵਾਲਾ ਵਗੈਰਾ ਉਹਨਾਂ ਦੇ ਰਿਕਰੂਟਮੈਂਟ ਵੀ ਆਪਣੀ ਲਿੰਕਡਇੰਨ 'ਤੇ ਹੋ ਜਾਂਦੀ ਆ ਹਾਂ ਅਤੇ ਵੀਰ ਜੀ ਮੈਨੂੰ ਕਰੰਟਲੀ ਇੰਨਾ ਐਕਸਪੀਰੀਅੰਸ ਹੈ ਨਹੀਂ ਮਤਲਬ ਤੁਸੀਂ ਦੱਸ ਸਕਦੇ ਹੋ ਤੁਹਾਡੇ ਆਸ ਪਾਸ ਕੋਈ ਸਕੂਲ ਵਗੈਰਾ ਹੋਵੇ ਜਿੱਥੇ ਮੈਂ ਕਰ ਸਕਾਂ ਸ ਆਪਣਾ ਵੀਰ ਜੀ ਕੋਲਜ ਦੇ ਵਿੱਚ ਥੋੜ੍ਹਾ ਔਖਾ ਹੁੰਦਾ ਆ ਕੋਲਜ ਦੇ ਹਿਸਾਬ ਨਾਲ ਮੈਂ ਪੁੱਛਣ ਗਿਆ ਸੀਗਾ ਉਹ ਕਹਿੰਦੇ ਆ ਤਿੰਨ ਜਾਂ ਚਾਰ ਪਲਸ ਐਕਪੀਰੀ ਈ ਸਾਲਾਂ ਦਾ ਐਕਸਪੀਰੀਐਂਸ ਮੰਗ ਰਹੇ ਸੀਗੇ ਅਤੇ ਮੇਰਾ ਤਾਂ ਹੈ ਨਹੀਂ ਗਾ ਹੁਣ ਮੈਂ ਹੁਣੇ ਨਵਾਂ ਨਵਾਂ ਪਾਸ ਆਊਟ ਹੈਗਾ ਹਾਂ ਨਾ ਮੈਨੂੰ ਥੋੜ੍ਹਾ ਧੱਕੇ ਖਾ ਰਿਹਾ ਜੋ ਨੌਕਰੀ ਮਿਲਦੀ ਨਹੀਂ ਪਈ ਕੋਈ ਘਰ ਦੇ ਔਖਾ ਹੋਇਆ ਕੰਮ ਇਸ ਕਰਕੇ ਤੁਸੀਂ ਨੌਕਰੀਆਂ ਮੈਨੂੰ ਦੱਸ ਸਕਦੇ ਹੋ ਮੈਂ ਐਮਐਸਈ ਕੀਤੀ ਹੈਗੀ ਅਤੇ ਹੋਰ ਮੈਂ ਕਿਹੜੀ ਕਿਹੜੀ ਜੋਬ ਕਰ ਸਕਦਾ ਹਾਂ ਵੀਰੇ ਮੈਨੂੰ ਕਰੰਟਲੀ ਟੀਚਿੰਗ ਆਂ ਵਧੀਆ ਕਰ ਲੈਂਦਾ ਮੈਂ ਵੈਸੇ ਮੈਂ ਹੋਰ ਚੀਜ਼ਾਂ ਵੀ ਦੱਸ ਸਿਖਾ ਸਕਦਾ ਹੈਗਾ ਸੋਸ਼ਲ ਸਾਇੰਸ ਵਗੈਰਾ ਹਿਸਟਰੀ ਵਗੈਰਾ ਵਿੱਚ ਵੀ ਬਹੁਤ ਵਧੀਆ ਹੈਗਾ ਮੈਂ ਮੇਰਾ ਮੇਨ ਸਰ ਮੈਂ ਗੌਰਮੈਂਟ ਸਰਵਿਸ ਦੇ ਵਿੱਚ ਕਰ ਸਕਦਾ ਪਰ ਮੈਨੂੰ ਉਸੇ ਬਾਰੇ ਵੀ ਪੜ੍ਹਨਾ ਪੈਣਾ ਬਾਅਦ 'ਚੋਂ ਉਦੋਂ ਵੀ ਪੜ੍ਹਨਾ ਹੁਣ ਵੀ ਮੈਂ ਐਮਐਸਈ ਕਰਕੇ ਹਟਿਆ ਹੁਣ ਇੰਨਾ ਪੜ੍ਹ ਲਏ ਹੁਣ ਵੀ ਜੋਬ ਨਹੀਂ ਮਿਲ ਰਹੀ ਤਾਂ ਹੁਣ ਮੈਂ ਅੱਗੇ ਪੜ੍ਹਾਂ ਕਿ ਨਾ ਅੱਗੇ ਆ ਕੇ ਨਾ ਜੋਬ ਮਿਲਦੇ ਇਸ ਕਰਕੇ ਤੁਹਾਨੂੰ ਪੁੱਛ ਰਿਹਾ ਮੈਂ

ਅੱਛਾ ਉਹ ਕਰਕੇ ਕਰੀਏ ਅੱਛਾ ਠੀਕ ਹੈ ਤੁਸੀਂ ਵੀ ਐਕਸਪੀਰੀਅੰਸ ਤੁਸੀਂ ਵੀ ਦਿੱਤਾ ਹੋਇਆ ਇਹ ਵਾਲਾ ਪੇਪਰ ਅੱਛਾ ਤੁਸੀਂ ਕਿਹੜੀ ਕੰਪਨੀ ਲੱਗੇ ਹੋਏ ਆਂ ਅੱਛਾ ਤੁਸੀਂ ਹੈਪੀ ਫੋਰਗਿੰਗ ਦੇ ਲੱਗੇ ਇਹ ਕਿੱਧਰ ਹੈਗੀ ਆ ਸਾਹਨੇਵਾਲ ਸਾਈਡ ਆ ਕੀ ਰਗਾਲ ਚੌਂਕ ਵਾਲੀ ਸਾਈਡ ਆ ਅੱਛਾ ਸਾਹਨੇਵਾਲ ਸਾਈਡ ਹੈਗੀ ਆ ਚਲੋ ਮੈਂ ਇਕ ਵਾਰ ਤੁਹਾਨੂੰ ਪਰਸਨਲੀ ਮਿਲ ਕੇ ਜਾਊਂਗਾ ਮੈਂ ਨਾ ਥੋੜ੍ਹਾ ਆਰਾਮ ਬੰਦੇ ਨਾਲ ਬਹਿ ਕੇ ਗੱਲ ਹੋ ਜਾਵੇ ਤਾਂ ਠੀਕ ਰਹਿੰਦਾ ਆ ਚਲੋ ਠੀਕ ਆ ਤੁਹਾਡਾ ਨੰਬਰ ਤਾਂ ਆਹੀ ਹੈ ਨਾ ਤੁਹਾਡਾ ਹਾਂਜੀ ਧੰਨਵਾਦ ਵੀਰ ਮੈਂ ਤੁਹਾਨੂੰ ਦੁਬਾਰਾ ਕਾਲ ਕਰੁੰਗਾ